ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਰ ਸਰ ਗੁਰਦੀਪ ਸਰ ਬੋਲਦੇ ਜੀ ਕੀ ਮੈਂ ਸਕੂਲ ਫੋਨ ਕੀਤਾ ਸੀਗਾ ਤੇ ਅਸਾਈਨਮੈਂਟ ਬਾਰੇ ਪੁੱਛਣਾ ਸੀ ਉਹ ਕਹਿੰਦੇ ਕੀ ਗੁਰਦੀਪ ਸਰ ਹੈਗੇ ਹਿਸਟਰੀ ਦੇ ਥੋਡੇ ਤੇ ਉਹਨਾਂ ਨੂੰ ਕੋਲ ਕਰਲੋ ਵੀ ਅੱਜ ਉਹ ਸਕੂਲ ਆਏ ਨੀ ਹੈਗੇ

ਅੱਛਾ ਅੱਛਾ ਜੀ ਮੈਖਾਂ ਜੀ ਜਿਹੜੀ ਅਸਾਈਨਮੈਂਟ ਦਿੱਤੀ ਹੋਈ ਸੀ ਉਹਨਾਂ ਨੇ ਫਰੀਡਮ ਫਾਈਟਰਾਂ ਬਾਰੇ ਜਿਵੇਂ ਉਹਦੇ ਪਰ ਉਹ ਬਣਾਣੀ ਸੀ ਤਾਂ ਕਰਕੇ ਉਹ ਫਰੀਡਮ ਫਾਈਟਰ ਬਾਰੇ ਥੋੜੀ ਥੋਤੋਂ ਜਾਣਕਾਰੀ ਲੈਣੀ ਸੀ ਜੀ ਹਾਂ ਉਹ ਹਾਂ ਪੰਜਾਬ ਦੇ ਆਪਣੇ ਫਰੀਡਮ ਫਾਈਟਰ ਪੁੱਛੇ ਹੋਏ ਆ ਕਿ ਆਪਣੇ ਪੰਜਾਬ ਦੇ ਕਿਹੜੇ ਕਿਹੜੇ ਫੀਡਮ ਫਾਈਟਰ ਹੋਏ ਆ ਤੇ ਉਹਨਾਂ ਬਾਰੇ ਥੋੜਾ ਬਹੁਤਾ ਲਿਖਣਾ ਹੈਗਾ ਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਇਹਦੇ ਬਾਰੇ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਹਾਂਜੀ ਕਿੱਥੇ ਜਨਮ ਹੋਇਆ ਜੀ ਕੀ ਕੀ ਕੀਤਾ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਤਾਂ ਹਾਂ ਆਪਣੇ ਦੇਸ਼ ਲਈ ਕੀ ਕੀਤਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਉਹਨਾਂ ਦੀ ਜੋ ਵੀ ਹਨ ਮਹੱਤਤਾ ਸੀਗੀ ਉੱਥੇ ਹਾਂਜੀ ਹਾਂਜੀ ਠੀਕ ਐ ਜੀ ਠੀਕ ਐ ਅੱਛਾ ਜੀ ਤੇ ਇਹ ਸਰ ਫਿਰ ਕਿੰਨੇ ਕ ਫਰੀਡਮ ਫਾਈਟਰ ਬਾਰੇ ਲਿਖਣਾ ਹੈਗਾ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਸਰ ਇਹ ਫਿਰ ਇਹਦੀ ਅਸਾਈਨਮੈਂਟ ਕਿੱਦਾਂ ਵੀ ਉਹਦੇ ਵਿੱਚ ਫਿਰ ਕੰਪਿਊਟਰ 'ਚ ਪ੍ਰੈਜਟੇਸ਼ਨ ਬਣਾਣੀ ਐ ਕਿ ਆਪਣੀ ਠੀਕ ਆ ਸਾਨੂੰ ਚੈੱਕ ਕਰਾ ਕੇ ਫੇਰ ਸਬਮਿਟ ਕਰਾਉਂਗਾ ਜੀ ਹੈਂ ਚਲੋ ਠੀਕ ਹੈ ਸਰ